ਕਿਸਾਨਾਂ ਨੂੰ ਪਸ਼ੂ ਪਾਲਣ ਲਈ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਏ ਕਿਸਾਨਾਂ ਨੂੰ ਪਸ਼ੂ ਪਾਲਣ ਦੀ ਕਰਨ ਲਈ ਉਹਨਾਂ ਦੀ ਦੇਖ ਵੇਲ ਉਹਨਾਂ ਦੇ ਖਾਣ ਪੀਣ ਦਾ ਸਮੇਂ ਸਮੇਂ 'ਤੇ ਧਿਆਨ ਰੱਖਣਾ ਪੈਂਦਾ ਏ ਉਹਨਾਂ ਦੀ ਮਤਲਬ ਕਿ ਉਹਨਾਂ ਦੇ ਪੱਠੇ ਲਿਆਉਣ ਲਈ ਉਹਨਾਂ ਨੂੰ ਕਾਫੀ ਦੂਰ ਦੂਰ ਤੱਕ ਜਾਣਾ ਪੈਂਦਾ ਏ ਖੇਤਾਂ ਵਿੱਚ ਹੋਰ ਵੀ ਕਾਫੀ ਜਗ੍ਹਾ 'ਤੇ ਨਹਿਰਾਂ ਦੇ ਕੰਢੇ ਉਹਨਾਂ ਦੇ ਪੱਠਿਆਂ ਵਾਸਤੇ ਉਹਨਾਂ ਨੂੰ ਦੂਰ ਦੂਰ ਤੋਂ ਲੈ ਕੇ ਆਉਣੇ ਪੈਂਦੇ ਆ ਤਾਂ ਕਿ ਉਹਨਾਂ ਨੂੰ ਇੰਨਾਂ ਦੂਰ ਤੋਂ ਸਫਰ ਕਰਨ ਉਹਨਾਂ ਨੇ ਇਹਨਾਂ ਦੇ ਨੇੜੇ ਤੇੜੇ ਹੀ ਉਹਨਾਂ ਦਾ ਦੇਖਭਾਲ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਉਹਨਾਂ ਨੂੰ ਆਸਾਨ ਹੋਵੇ ਭੱਠਿਆਂ ਲਿਆਉਣ ਵਿੱਚ ਵੀ ਅਤੇ ਉਹਨਾਂ ਨੂੰ ਦੇਣ ਵਿੱਚ ਉਹਨਾਂ ਤੋਂ ਸਮੇਂ ਸਮੇਂ ਵਿੱਚ ਧਿਆਨ ਰੱਖਦਾ ਏ ਅਤੇ ਉਹਨਾਂ ਨੂੰ ਦੇਖਭਾਲ ਅਤੇ ਉਹਨਾਂ ਦੇ ਕਈ ਵਾਰੀ ਡੋਕਟਰ ਦੀ ਵੀ ਇਲਾਜ ਕਰਵਾ ਲੈਣੀ ਚਾਹੀਦੀ ਹੈ ਡੋਕਟਰ ਨਾਲ ਵੀ ਦੇਖਭਾਲ ਕਰਵਾ ਦੇਣੀ ਚਾਹੀਦੀ ਹੈ ਜੇਕਰ ਮਤਲਬ ਕਿ ਕਈ ਵਾਰੀ ਜਿਹੜੇ ਦ ਪਸ਼ੂਆਂ ਦੀ ਦੇਖਭਾਲ ਕਰਦੇ ਆ ਉਹਨਾਂ ਨੂੰ ਕਿਤੇ ਬਾਹਰ ਜਾਣਾ ਪੈਂਦਾ ਏ ਤਾਂ ਘਰ ਵਿੱਚ ਜੇ ਹੋਰ ਕੋਈ ਮੈਂਬਰ ਰਹਿੰਦੇ ਆ ਤਾਂ ਉਹਨਾਂ ਨੂੰ ਦੇਖਭਾਲ ਕਰਨ ਲਈ ਛੱਡ ਦਿੱਤਾ ਜਾਂਦਾ ਏ ਤਾਂ ਪਰ ਵੈਸੇ ਜਿਹਨਾਂ ਨੂੰ ਮਤਲਬ ਅਸੀਂ ਖੇਤਾਂ ਪਸ਼ੂਆਂ ਦੀਆਂ ਜਾਂ ਦੇਖਭਾਲ ਕਰਨ ਲਈ ਛੱਡ ਦਿੰਦੇ ਆ ਉਹ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਨਹੀਂ ਕਰਦੇ ਹੈਗੇ ਆ ਮਤਲਬ ਕਿ ਇੱਕ ਟਾਈਮ ਦੇ ਦਿੰਦੇ ਆ ਫਿਰ ਕਿਤੇ ਸਵੇਰੇ ਦੇ ਦਿੰਦੇ ਆ ਪਸ਼ੂ ਪਸਾਂ ਨੂੰ ਪੱਠੇ ਤਾਂ ਫਿਰ ਸ਼ਾਮ ਨੂੰ ਸਿੱਧਾ ਜਾ ਕੇ ਇੱਦਾਂ ਉਹਨਾਂ ਦੀ ਹੈਲਥ 'ਤੇ ਵੀ ਉਹ ਅਸਰ ਪੈਂਦਾ ਏ ਅਤੇ ਮਤਲਬ ਕਿ ਸ ਇੱਦਾਂ ਕਈ ਪਿੰਡਾਂ ਵਿੱਚ ਵੀ ਇੱਦਾਂ ਹੁੰਦਾ ਏ ਕਿ ਇਹ ਸਵੇਰੇ ਮਤਲਬ ਕਿ ਉਹਨਾਂ ਨੂੰ ਦੇ ਪੱਠੇ ਦੇ ਤੇ ਫਿਰ ਛੱਡ ਦਿੰਦੇ ਆ ਐਦੀਂ ਮਤਲਬ ਘੁੰਮਦੇ ਰਹਿੰਦੇ ਆ ਪਿੰਡ ਵਿੱਚ ਵੀ ਸਾਰੀ ਜਗ੍ਹਾ ਦੁਪਹਿਰ ਦੁਪਹਿਰ ਤੱਕ ਦੀ ਹ ਗਲੀਆਂ ਵਿੱਚ ਸੜਕਾਂ ਵਿੱਚ ਐਦੀਂ ਘੁੰਮਦੇ ਰਹਿੰਦੇ ਕਈ ਵਾਰੀ ਮਤਲਬ ਉਹ ਗੱਡੀਆਂ ਅੱਗੇ ਵੀ ਆ ਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਏ ਉਹਨਾਂ ਦੀ ਦੈਥ ਹੋ ਜਾਂਦੀ ਹੈ ਇਹਦੇ ਨਾਲ ਮਤਲਬ ਕਾਫੀ ਪ੍ਰਭਾਵ ਪੈਂਦਾ ਹੈਗਾ ਪਸ਼ੂਆਂ 'ਤੇ